ਸਾਡੇ ਸੱਭਿਆਚਾਰਕ ਵਿੱਚ ਬਹੁਤ ਤਰ੍ਹਾਂ ਦੀਆਂ ਪਰੰਪਰਾਵਾਂ ਹਨ ਜਿਵੇਂ ਬੱਚਾ ਇੱਕ ਬੱਚਾ ਜਨਮ ਲੈਂਦਾ ਹੈ ਉਸ ਬੱਚੇ ਦੇ ਜਨਮ ਤੋਂ ਬਾਅਦ ਉਸ ਨੂੰ ਗੁੜ੍ਹਤੀ ਦਿੱਤੀ ਜਾਂਦੀ ਹੈ ਜੋ ਉਸ ਪਰਿਵਾਰ ਦਾ ਇੱਕ ਮੈਂਬਰ ਉਸ ਨੂੰ ਗੁੜ੍ਹਤੀ ਦਿੰਦਾ ਹੈ ਉਸ ਗੁੜ੍ਹਤੀ ਦੇਣ ਤੋਂ ਬਾਅਦ ਉਸ ਬੱਚੇ ਦਾ ਨਾਮਕਰਨ ਕੀਤਾ ਜਾਂਦਾ ਹੈ ਉਸ ਬੱਚੇ ਦਾ ਨਾਮਕਰਨ ਜਾਂ ਤਾਂ ਇੱਕ ਘਰ ਪਰਿਵਾਰ ਦਾ ਮੈਂਬਰ ਰੱਖਦਾ ਹੈ ਜਾਂ ਫਿਰ ਗੁਰਦੁਆਰਾ ਸਾਹਿਬ ਵਿੱਚ ਹੁਕਮਨਾਮਾ ਪੜ੍ਹਿਆ ਜਾਂਦਾ ਹੈ ਹੁਕਮਨਾਮੇ ਵਿੱਚੋਂ ਪਹਿਲੇ ਅਕਸ਼ਰ ਵਿੱਚੋਂ ਜੋ ਪਹਿਲਾ ਅਕਸ਼ਰ ਆਉਂਦਾ ਹੈ ਉਸ ਪਹਿਲੇ ਅਕਸ਼ਰ ਦੇ ਉੱਤੇ ਉਸ ਬੱਚੇ ਦਾ ਨਾਮਕਰਨ ਕੀਤਾ ਜਾਂਦਾ ਹੈ ਉਸ ਤੋਂ ਬਾਅਦ ਉਸ ਬੱਚੇ ਦੀ ਪਹਿਲੀ ਲੋਹੜੀ ਮਨਾਈ ਜਾਂਦੀ ਹੈ ਲੋਹੜੀ ਵਿੱਚ ਹਰ ਇੱਕ ਰਸਮ ਕੀਤੀ ਜਾਂਦੀ ਹੈ ਜਿੱਦਾਂ ਪਿੰਡ ਨੂੰ ਲੋਹੜੀ ਵੰਡੀ ਜਾਂਦੀ ਹੈ ਪਿੰਡ ਦੀਆਂ ਔਰਤਾਂ ਨਚਾਈਆਂ ਜਾਂਦੀਆਂ ਹਨ ਡੀਜੇ 'ਤੇ ਨਚਾਏ ਜਾਂਦੇ ਹਨ ਜਾਂ ਫਿਰ ਘਰ ਵਿੱਚ ਪਾਠ ਕਰਵਾਏ ਜਾਂਦੇ ਹਨ ਉਸ ਤੋਂ ਬਾਅਦ ਉਸ ਬੱਚੇ ਨੂੰ ਦਸਤਾਰ ਸੌਂਪੀ ਜਾਂਦੀ ਹੈ ਉਸ ਦੇ ਪਿਤਾ ਜੀ ਦੀ ਉਸ ਦੇ ਪਿਤਾ ਜੀ ਦੀ ਹਰ ਇੱਕ ਜ਼ਿੰਮੇਵਾਰੀ ਉਸ ਬੱਚੇ ਨੂੰ ਸੌਂਪੀ ਜਾਂਦੀ ਹੈ ਉਸ ਬੱਚੇ ਨੂੰ ਹਰ ਇੱਕ ਕਬੀਲਦਾਰੀ ਦਿੱਤੀ ਜਾਂਦੀ ਹੈ ਉਸ ਤੋਂ ਬਾਅਦ ਉਸ ਬੱਚੇ ਦਾ ਜਿਉਂ ਜਿਉਂ ਬੱਚਾ ਵੱਡਾ ਹੁੰਦਾ ਹੈ ਉਸਦੀ ਵਿਆਹ ਉਸ ਦਾ ਵਿਆਹ ਕਰ ਦਿੱਤਾ ਜਾਂਦਾ ਹੈ ਵਿਆਹ ਵਿੱਚ ਉਸ ਬੱਚੇ ਨੂੰ ਉਸ ਦੀਆਂ ਭੈਣਾਂ ਉਸ ਦੀਆਂ ਭੈਣਾਂ ਉਸ ਦੇ ਵਾਲ਼ ਝਾੜਦੀਆਂ ਹਨ ਜੋ ਰਸਮ ਹੁੰਦੀ ਹੈ ਉਸ ਰਸਮ ਨੂੰ ਪੂਰੀਆਂ ਕਰਦੀਆਂ ਹਨ ਉਸ ਦੀ ਭਰਜਾਈ ਉਸ ਬੱਚੇ ਦੀ ਭਰਜਾਈ ਉਸ ਦੇ ਸੁਰਮਾ ਪਾਉਂਦੀ ਹੈ ਸੁਰਮਾ ਪਾਉਣ ਤੋਂ ਬਾਅਦ ਉਸ ਨੂੰ ਇੱਕ ਵਿਆਹ ਦੀ ਜ਼ਿੰਮੇਵਾਰੀ ਵਿੱਚ ਬੰਨ੍ਹ ਦਿੱਤਾ ਜਾਂਦਾ ਹੈ ਉਸ ਤੋਂ ਬਾਅਦ ਉਸ ਬੱਚੇ ਦੀ ਉਸ ਇਨਸਾਨ ਦੀ ਮੌਤ ਹੋ ਜਾਂਦੀ ਹੈ ਮੌਤ ਹੋਣ ਤੋਂ ਬਾਅਦ ਉਸ ਬੱਚੇ ਨੂੰ ਨਾਈ ਧੋਈ ਕਰਵਾਈ ਜਾਂਦੀ ਹੈ ਨਾਈ ਧੋਈ ਤੋਂ ਬਾਅਦ ਉਸ ਨੂੰ ਪੰਜ ਤੱਤਾਂ ਵਿੱਚ ਮਿਲਾ ਦਿੱਤਾ ਜਾਂਦਾ ਹੈ ਅਤੇ ਸਾਡੇ ਸੱਭਿਆਚਾਰਕ ਦੀਆਂ ਪਰੰਪਰਾਵਾਂ ਹਨ ਜਿਵੇਂ ਸਿੱਧ 'ਤੇ ਜਾਣਾ ਵੀਰਵਾਰ ਮਿੱਠੇ ਚਾਵਲ ਪੀਰਾਂ ਦੀ ਜਗ੍ਹਾ 'ਤੇ ਜਾਣਾ ਸ਼ੀਤਲਾ ਮਾਤਾ ਦੇ ਮਿੱਠੇ ਗੁਲਗੁਲੇ ਇੱਦਾਂ ਦੀਆਂ ਸੱਭਿਆਚਾਰਕ ਪਰੰਪਰਾਵਾਂ ਸਾਡੇ ਜੀਵਨ ਵਿੱਚ ਆਉਂਦੀਆਂ ਹਨ